ਹਾਂ ਜੇਕਰ ਮੌਕਾ ਦਿੱਤਾ ਜਾਵੇ ਤਾਂ ਮੈਂ ਭਾਰਤ ਦੀਆਂ ਕਲਾ ਸ਼ੈਲੀਆਂ ਦੂਸਰੇ ਦੇਸ਼ਾਂ ਨੂੰ ਦਿਖਾਣਾ ਚਾਹੂੰਗੀ ਕਿਉਂਕਿ ਇਸ ਵਿੱਚ ਸਿੱਖ ਅਤੇ ਮੁਗ਼ਲ ਸਿੰਘਾਸਨਾਂ ਦੀ ਸਿੱਖ ਸੰਸਕ੍ਰਿਤੀ ਅਤੇ ਮੁਗ਼ਲ ਸਿੰਘਾਸਨਾਂ ਦੀ ਆਰਾਮਦਾਇਕ ਅਤੇ ਸ਼ਾਨਦਾਰ ਸ਼ੈਲੀ ਸ਼ਾਮਿਲ ਹੈ ਸਾਂਝੀ ਗੁਣਵੱਤਾ ਇਨ੍ਹਾਂ ਦੀ ਖਾਸਤਾ ਹਨ ਜਿਵੇਂ ਕਿ ਸੁੰਦਰ ਰੰਗ ਕੌਮੀ ਪਾਰਟੀਆਂ ਵਿਗਿਆਨੀ ਅਤੇ ਧਾਰਮਿਕ ਚਿੱਤਰਾਂ ਅਤੇ ਰੰਗੀਨ ਲਾਹਣਾਂ ਵਿੱਚ ਆਧੁਨਿਕ ਸਿੱਖ ਅਤੇ ਮੁਗ਼ਲ ਕਲਾ ਦੀ ਚਮਕ ਦੀ ਸਾਂਝੀ ਮਿਲਾਵਟ ਹੈ ਭਾਰਤੀ ਕਲਾ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਭਗਤਾਂ ਦੀ ਭਗਤੀ ਅਤੇ ਸੰਗੀਤ ਦੀ ਮਹੱਤਤਾ ਵੀ ਹੈ ਭਾਰਤੀ ਕਲਾ ਵਿੱਚ ਲੋਕ ਕਲਾਕਾਰੀ ਗੁਰਮੁਖੀ ਲਿੱਪੀ ਅਤੇ ਅਨੁਰਾਗ ਦਾ ਰੰਗ ਵੀ ਸ਼ਾਮਿਲ ਹੈ ਭਾਰਤੀ ਕਲਾ ਵਿੱਚ ਸਾਹਿਤਕ ਅਤੇ ਸੰਗੀਤ ਸ ਸੰਗੀਤਕ ਵਿਰਾਸਤ ਵੀ ਸ਼ਾਮਿਲ ਹੈ